ਹਾਂਜੀ ਦਵਿੰਦਰ ਸਿੰਘ ਜੀ ਮੈਨੂੰ ਦੱਸੋ ਤੁਸੀਂ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਹੋ ਮੈਂ ਆਪਣੇ ਵਿਹਲੇ ਸਮੇਂ ਦੇ ਵਿੱਚ ਕਈ ਵਾਰ ਕ ਗਰਾਉਂਡ ਦੇ ਵਿੱਚ ਕ੍ਰਿਕਟ ਖੇਡਣ ਚਲਾ ਜਾਂਦਾ ਹਾਂ ਅਤੇ ਉੱਥੇ ਜਾ ਕੇ ਮੇਰਾ ਕਾਫੀ ਵਧੀਆ ਸਮਾਂ ਬਤੀਤ ਹੁੰਦਾ ਹੈ ਉਸ ਤੋਂ ਬਾਅਦ ਫਿਰ ਮੈਂ ਜਦੋਂ ਫ੍ਰੀ ਹੁੰਦਾ ਤਾਂ ਮੈਂ ਆਪਣੀ ਮੋਟਰ 'ਤੇ ਚਲਾ ਜਾਂਦਾ ਹਾਂ ਉੱਥੇ ਜਾ ਕੇ ਆਪਣੇ ਹੱਥੀਂ ਕੰਮ ਕਰਦਾ ਅਤੇ ਮੇਰੇ ਦੋ ਮਜ਼ਦੂਰ ਰੱਖੇ ਨੇ ਉਹਨਾਂ ਦੇ ਨਾਲ ਹੈਲਪ ਕਰਾਉਂਦੇ ਹਾਂ ਅਸੀਂ ਬੈਠੇ ਕਈ ਵਾਰ ਕੋਈ ਗਾਣੇ ਸੁਣ ਲਈ ਦੇ ਆ ਜਿਵੇਂ ਖੇਤਾਂ 'ਚ ਕੰਮ ਕਰ ਲੈਂਦੇ ਹਾਂ ਅਤੇ ਬਾਜ਼ਾਰ ਘੁੰਮਣ ਚਲੇ ਜਾਂਦੇ ਹਾਂ ਅਤੇ ਸ਼ ਜੇ ਸਮਾਂ ਹੋਇਆ ਤਾਂ ਵਧੀਆ ਮੌਸਮ ਹੁੰਦਾ ਕਈ ਵਾਰ ਡਰਿੰਕ ਕਰ ਲੈਂਦੇ ਹਾਂ ਅਤੇ ਮੇਰੇ ਹੋਰ ਯਾਰ ਦੋਸਤ ਆ ਜਾਂਦੇ ਨੇ ਉੱਥੇ ਅਸੀਂ ਤ ਤਾਸ਼ ਖੇਡ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਜੇ ਅਸੀਂ ਸ਼ਾਮ ਨੂੰ ਚੰਡੀਗੜ੍ਹ ਵਗੈਰਾ ਜਾਂ ਹੋਰ ਕਿਤੇ ਵਧੀਆ ਸਿਟੀ ਦੇ ਵਿੱਚ ਘੁੰਮਣ ਚਲੇ ਜਾਂਦੇ ਹਾਂ ਅਤੇ ਉੱਥੇ ਮੋਲ ਦੇ ਵਿੱਚ ਆਪਣੀ ਸ਼ੋਪਿੰਗ ਕਰਦੇ ਹਾਂ ਕੋਈ ਮੂਵੀ ਦੇਖ ਲਈ ਕੋਈ ਪਾਰਕ 'ਚ ਘੁੰਮ ਲਿਆ ਕੋਈ ਜੈਸਟ ਜਿਵੇਂ ਸਵੀਮਿੰਗ ਸਵੀਮਿੰਗ ਕਰ ਲਈ ਫਰੀ ਸਮੇਂ ਦੇ ਵਿੱਚ ਅਸੀਂ ਜਿੰਮ ਵੀ ਕਰ ਸਕਦੇ ਹਾਂ ਅਤੇ ਜਿਵੇਂ ਆਪਣਾ ਕਿਤੇ ਅ ਜੇ ਤੁਸੀਂ ਹੋਰ ਕੰਮ ਨਹੀਂ ਕਰ ਸਕਦੇ ਤਾਂ ਆਪਣਾ ਗੁਰੂ ਘਰ ਚਲੇ ਜਾਓ ਉੱਥੇ ਜਾ ਕੇ ਤੁਸੀਂ ਸੇਵਾ ਕਰ ਸਕਦੇ ਹੋ